ਸਪੀਕ ਆਊਟ ਦਾ ਪਲੋਇੰਗ ਨੇਮਸ ਓਫ ਵੀਕਲਸ ਹਿੰਟ ਐੱਲ ਡੀ ਵੀ ਮੈਕਸਸ ਬੀ ਐੱਮ ਡਬਲਿਊ ਐਕਸ ਥਰੀ ਐਕਸ ਈ ਆਰ ਆਈ ਵੀ ਈ ਥਰੀ ਜੀਰੋ ਓ ਈ ਲੈਬਰੋਗਿਨੀ ਰੀਵੇਚਨ